ਹੈਲੋ ਗੁੱਡ ਮੋਰਨਿੰਗ ਜੀ ਹਾਂਜੀ ਹਾਂਜੀ ਹਾ ਹਾਂਜੀ ਹਾਂਜੀ ਹਾਂਜੀ ਹੈਗੀਆ ਹੈ ਜੀ ਕਿਹੜੀ ਕਿਹੜੀ ਚਾਹੀਦੀ ਹੈ ਜੀ ਤੁਹਾਨੂੰ ਹੋਰ ਕਿਹੜੀਆਂ ਬੁੱਕਸ ਇਹਦੇ ਨਾਲ਼ ਦੀਆਂ ਚਾਹੀਦੀਆਂ ਹੈ ਜੀ ਇਹ ਤਾਂ ਦੋਨੋਂ ਜੀ ਹੈਗੀਆ ਹੈ ਹਾਂਜੀ ਹਾਂਜੀ ਥੋੜੀਆਂ ਜਿਹੀਆਂ ਬੁੱਕਸ ਤਾਂ ਸਾਡੇ ਕੋਲ ਅਵੇਲੇਵਲ ਹੈਗੀਆ ਥੋੜੀਆ ਜਿਹੀਆਂ ਨਹੀਂ ਹੈਗੀਆਂ ਕੋਈ ਗੱਲ ਨੀ ਜੇ ਤੁਸੀਂ ਮੈਨੂੰ ਜਾਂ ਤਾਂ ਲਿਸਟ ਭੇਜ਼ ਦਿਓ ਸਾਡੇ ਕੋਲ ਪੰਜਾਬੀ ਸਾਹਿਤ ਦੀਆਂ ਬੁੱਕਸ ਤਾਂ ਹੈਗੀਆਂ ਨੇ ਤੇ ਬਾਕੀ ਜਿਹੜੇ ਤੁਸੀਂ ਹੋਰ ਨਾਮ ਲਿਆ ਜਿਵੇਂ ਭਾਈ ਵੀਰ ਸਿੰਘ ਜੀ ਠੀਕ ਹੈ ਜੀ ਠੀਕ ਹੈ ਜੀ ਤੁਹਾਨੂੰ ਸਾਰੀਆਂ ਅਵੇਲੇਵਲ ਕਰਵਾ ਦੇਵਾਂਗੇ ਜੀ ਪਰ ਤੁਸੀਂ ਸਾਨੂੰ ਉਹਦੇ ਲਈ ਆਪਣੀ ਲਿਸਟ ਭੇਜ਼ ਦਿਓ ਕਿਹੜੇ ਜੀ ਠੀਕ ਹੈ ਜੀ ਤੁਸੀਂ ਸਾਨੂੰ ਲਿਸਟ ਅਵੇਲੇਵਲ ਕਰਵਾਦੋ ਅਸੀਂ ਤੁਹਾਨੂੰ ਚਾਹੇ ਔਨਲਾਈਨ ਭੇਜ਼ ਦੇਵਾਂਗੇ ਜੀ ਚਾਹੇ ਤੁਸੀਂ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਅਵੇਲੇਵਲ ਕਰਵਾ ਦਵਾਂਗੇ ਪੰਦਰਾਂ ਦਿਨਾਂ 'ਚ ਠੀਕ ਹੈ ਜੀ ਓਕੇ ਜੀ